ਹੈਲੋ ਸਤਿ ਸ਼੍ਰੀ ਅਕਾਲ ਸਰ ਗੁਰਪ੍ਰੀਤ ਟਰੈਵਲ ਏਜੰਸੀ ਤੋਂ ਬੋਲਦੇ ਜੀ ਮੈਨੂੰ ਮੇਰੇ ਦੋਸਤ ਗਗਨਪ੍ਰੀਤ ਸਿੰਘ ਨੇ ਤੁਹਾਡਾ ਨੰਬਰ ਦਿੱਤਾ ਤਾ ਜੀ ਮੈਂ ਨਾ ਮੋਹਾਲੀ ਤੋਂ ਗੱਲ ਕਰਦਾ ਅਤੇ ਨਾ ਮੇਰੇ ਪਰਿਵਾਰ ਦੇ ਚਾਰ ਜੀਅ ਅਸੀਂ ਨਾ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਉਹਦੇ ਨਾਲ ਜਿੰਨੇ ਵੀ ਧਾਰਮਿਕ ਅਸਥਾਨ ਹੈ ਉਹਨਾਂ ਦੀ ਯਾਤਰਾ ਕਰਨੀ ਹੈ ਅਤੇ ਇਸ ਸੰਬੰਧੀ ਆਪਣੇ ਕੋਲ ਕੀ ਕੀ ਸਹੂਲਤਾਂ ਨੇ ਅਤੇ ਕਿੰਨਾ ਖਰਚਾ ਆਵੇਗਾ ਜੀ ਚਾਰ ਕੁ ਦਿਨ ਨੇ ਸਾਡੇ ਕੋਲ ਫ੍ਰੀ ਵੀਕਐਂਡ ਦੇ ਠੀਕ ਹੈ ਜੀ ਅੱਛਾ ਜੀ ਅਤੇ ਉਹ ਆਪਣਾ ਘੁੰਮਣ ਲਈ ਜਾਣ ਲਈ ਗੱਡੀ ਵੀ ਆਪਣੇ ਵੱਲੋਂ ਹੀ ਹੋਵੇਗੀ ਅਤੇ ਇਹ ਬਿਲਕੁਲ ਸੁਰੱਖਿਆ ਸੁਰੱਖਿਅਤ ਹੋਵੇਗਾ ਜੀ ਕਿਉਂਕਿ ਮੈਂ ਆਪਣੀ ਫੈਮਲੀ ਨਾਲ ਆਉਣਾ ਜੀ ਅਤੇ ਇਹਦੇ ਵਿੱਚ ਮੇਰੇ ਦੋਸਤ ਨੇ ਕਿਹਾ ਸੀ ਵੀ ਜੇ ਵੀ ਮੈਂ ਉਹਦਾ ਨਾਮ ਲੈ ਦੇਵਾਂ ਤਾਂ ਤੁਸੀਂ ਕੁਝ ਡਿਸਕਾਊਂਟ ਵਗੈਰਾ ਕਰ ਦੋਂਗੇ ਠੀਕ ਹੈ ਜੀ ਜੀ ਜੀ ਠੀਕ ਹੈ ਜੀ ਫਿਰ ਮੈਂ ਤੁਹਾਡੇ ਨੂੰ ਤੁਹਾਨੂੰ ਕਦੋਂ ਮਿਲ ਸਕਦਾ ਕਿੰਨੇ ਵਜੇ ਕਿੱਥੇ ਦਾ ਠੀਕ ਹੈ ਜੀ ਫੇਰ ਮੈਂ ਕੱਲ੍ਹ ਠੀਕ ਹੈ ਜੀ ਮੈਂ ਕੱਲ੍ਹ ਨੂੰ ਸਵੇਰੇ ਦਸ ਵਜੇ ਤੁਹਾਡੇ ਕੋਲ ਆਉਂਗਾ ਜੀ ਤੁਹਾਡੇ ਦਫ਼ਤਰ 'ਚ ਫੇਰ ਉੱਥੇ ਬਾਕੀ ਬਹਿ ਕੇ ਉੱਥੇ ਗੱਲ ਕਰ ਲਵਾਂਗੇ ਜੀ ਠੀਕ ਹੈ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ